ਹੈਲੋ ਹਾਂਜੀ ਸਰ ਤੁਸੀਂ ਅਨੇਜਾ ਸਵੀਟਸ ਤੋਂ ਬੋਲਦੇ ਹੋ ਮੈਂ ਅਮਨਪ੍ਰੀਤ ਕੌਰ ਅਰਬਨ ਸਟੇਟ ਹਾਊਸ ਨੰਬਰ ਪੰਜ ਤੋਂ ਬੋਲਦੀ ਹਾਂ ਮੈਂ ਕੁਝ ਸਮਾਂ ਪਹਿਲਾਂ ਆਪਣਾ ਲੰਚ ਔਡਰ ਕੀਤਾ ਸੀ ਜੋ ਮੇਰੇ ਘਰ ਪਹੁੰਚ ਗਿਆ ਐਗਾ ਪਰ ਮੈਂ ਕੁਝ ਸਮਾਨ ਭੁੱਲ ਗਈ ਜਿਵੇਂ ਕਿ ਡਿਪੋਜ਼ੇਬਲ ਪਲੇਟਾਂ ਚਮਚ ਅਤੇ ਗਲਾਸ ਤੁਸੀਂ ਉਹਨਾਂ ਦਾ ਔਡਰ ਦੁਬਾਰਾ ਭੇਜ ਸਕਦੇ ਹੋ ਮੇਰੇ ਘਰ ਠੀਕ ਹੈ ਜੀ ਸਰ ਮੈਨੂੰ ਇਹ ਸਵੀਟ ਡਿਸ਼ ਵੀ ਚਾਹੀਦੀ ਸੀ ਗੁਲਾਬ ਜਾਮਨ ਅਤੇ ਰਸਗੁੱਲੇ ਅੱਧਾ ਅੱਧਾ ਕਿੱਲੋ ਉਹ ਭੇਜ ਦੇਣਾ ਜੀ ਸਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿੰਨੇ ਵਾਰ ਵੀ ਮੈਂ ਤੁਹਾਨੂੰ ਲੰਚ ਜਾਂ ਡਿਨਰ ਔਡਰ ਕੀਤਾ ਗਾ ਤੁਹਾਡਾ ਲੰਚ ਅਤੇ ਡਿਨਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਅਤੇ ਮੈਨੂੰ ਤੁਹਾਡੀ ਜਿਹੜੀ ਮਿਕਸ ਵੈੱਜ ਆ ਅਤੇ ਦਾਲ ਮੱਖਣੀ ਆ ਬਹੁਤ ਜ਼ਿਆਦਾ ਸਵਾਦ ਲੱਗਦੀ ਐਗੀ ਅਤੇ ਤੁਹਾਡਾ ਜਿਹੜਾ ਖਾਣਾ ਗਾ ਬਹੁਤ ਜ਼ਿਆਦਾ ਹਾਈਜੀਨਿਕ ਜ਼ਿਤੇ ਸਾਫ਼ ਸੁਥਰਾ ਹੁੰਦਾ ਗਾ ਅਤੇ ਮੈਂ ਇਹ ਤੁਹਾਡੀ ਜਿਹੜੀ ਟਾਈਮਿੰਗ ਆ ਬਹੁਤ ਜ਼ਿਆਦਾ ਵਧੀਆ ਗੀ ਟਾਈਮ ਦੇ ਨਾਲ ਤੁਸੀਂ ਖਾਣਾ ਪਹੁੰਚਾ ਦਿੰਦੇ ਓਂਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਦੇ ਲਈ ਧੰਨਵਾਦ ਜੀ